ਹੈਲੋ ਤੁਸੀਂ ਸਵਿਗੀ ਤੋਂ ਬੋਲਦੇ ਜੀ ਸਾਡੇ ਘਰ ਨਾ ਬਡ ਬ੍ਰਥਡੇ ਦਾ ਇੱਕ ਪਾਰਟੀ ਆ ਵੀਹ ਮਾਰਚ ਨੂੰ ਉਹਦੇ ਸੰਬੰਧ 'ਚ ਨਾ ਤੁਹਾਨੂੰ ਅਸੀਂ ਆਡਰ ਕੀਤਾ ਹੋਇਆ ਪਹਿਲਾਂ ਹੀ ਖਾਣ ਦਾ ਅਤੇ ਅਸੀਂ ਨਾ ਐਡ ਕਰਵਾਉਣਾ ਚਾਹੁੰਦੇ ਹਾਂ ਉਹਦੇ ਵਿੱਚ ਜਿਵੇਂ ਕੋਈ ਕੋਕ ਹੋਗ ਹੋ ਗਿਆ ਜੂਸ ਹੋ ਗਿਆ ਇਹ ਤੁਹਾਡੇ ਕੋਲ ਕਿਹੜੀ ਕਿਹੜੀ ਕੁਆਲਿਟੀ ਦੇ ਅਤੇ ਕਿਹੜੀ ਕਿਹੜੀ ਪੈਕਿੰਗ ਦੇ ਵਿੱਚ ਅਵੇਲੇਬਲ ਆ ਤੁਸੀਂ ਨਾਲ ਨਾਲ ਸਾਡੇ ਐਡ ਕਰ ਦਿਓ ਵਿੱਚ ਉਹ ਵੀ ਜਿੰਨਾ ਵੀ ਹੋ ਸਕਦਾ ਵਾ ਵੱਧ ਤੋਂ ਵੱਧ ਅਸੀਂ ਚਾਹੁੰਦੇ ਹਾਂ ਤੁਹਾਡੇ ਕੋਲ ਹੀ ਜਿਹੜਾ ਸਾਡਾ ਆਡਰ ਜਾਵੇ ਆਪ ਸਾਡਾ ਨਾ ਸੌ ਕੁ ਬੰਦੇ ਦਾ ਹੈਗਾ ਅਰੇਂਜਮੈਂਟ ਅਤੇ ਮਹਿਮਾਨ ਸਾਡੇ ਆ ਜਾਣੇ ਆ ਨੌ ਦਸ ਵਜੇ ਤੋਂ ਸਟਾਰਟ ਹੋ ਜਾਣਾ ਸਾਨੂੰ ਨੌ ਵਜੇ ਅਰਲੀ ਮੌਰਨਿੰਗ ਚਾਹੀਦਾ ਵਾ ਸਾਰਾ ਹੀ ਸਮਾਨ ਸਾਰਾ ਜਿਹਦੇ ਵਿੱਚ ਤੁਸੀਂ ਪੰਜਾਹ ਪੇਟੀਆਂ ਕੋਕ ਦੀਆਂ ਫੈਂਟਾ ਲਿਮਕਾ ਮਰਿੰਡਾ ਅਤੇ ਕੋਕੋ ਕੋਲਾ ਮਿਕਸ ਕਰ ਲੈਣਾ ਮਿਕਸ ਭੇਜ ਦਿਓ ਅਤੇ ਨਾਲ ਜੂਸ ਦਾ ਵੀ ਭੇਜ ਦਿਓ ਅਲੱਗ ਅਲੱਗ ਬ੍ਰੈਂਡ ਦਸ ਪੇਟੀਆਂ ਜੂਸ ਦੀਆਂ ਭੇਜ ਦਿਓ ਅਤੇ ਦੋ ਕਿਲੋ ਸਾਡਾ ਮੱਖਣ ਹੈਗਾ ਜੇ ਜੇ ਮੱਖਣ ਵੀ ਤੁਹਾਡੇ ਕੋਲ ਹੁੰਦਾ ਤਾਂ ਉਹ ਵੀ ਭੇਜ ਦਿਓ ਨਾਲ ਹੀ ਨਾਲ ਸਾਡੇ ਪਨੀਰ ਚਾਹੀਦਾ ਸਾਨੂੰ ਚਾਰ ਕਿਲੋ ਤੁਸੀਂ ਜਿੱਥੋਂ ਤੱਕ ਹੋ ਸਕਿਆ ਸਾਨੂੰ ਵਧੀਆ ਕੁਆਲਿਟੀ ਦਾ ਸਾਰਾ ਸਮਾਨ ਅਤੇ ਨੌ ਵਜੇ ਤੱਕ ਪਹੁੰਚਾ ਦਿਓ ਜਿਹੜਾ ਸਾਡੇ ਨਾ ਪਾਰਟੀ ਦੇ ਵਿੱਚ ਕੋਈ ਵਿਘਨ ਨਾ ਪਵੇ